ਭਾਰਤ ਦੀ ਆਜ਼ਾਦੀ ਦੀ ਲਹਿਰ ਇੱਕ ਉਹ ਲਹਿਰ ਸੀ ਕਿ ਜਿਸਨੇ ਭਾਰਤ ਦੀ ਆਜ਼ਾਦੀ ਪ੍ਰਾਪਤ ਕਰਨ ਦੀ ਇੱਕ ਮਨ ਦੇ ਵਿੱਚ ਸੰਕਲਪ ਆਇਆ ਭਾਰਤ ਦੇ ਕਈ ਹੋਣਹਾਰ ਜਾਂ ਅਣਖੀ ਸੂਰਬੀਰਾਂ ਨੇ ਬਹਾਦਰਾਂ ਨੇ ਆਜ਼ਾਦੀ ਪ੍ਰਾਪਤ ਕਰਨ ਦਾ ਸੁਪਨਾ ਸੋਚਿਆ ਕਿਉਂਕਿ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਇੱਥੇ ਬਹੁਤ ਸਾਰੇ ਵਿਦੇਸ਼ੀ ਹਮਲਾਵਰ ਆ ਕੇ ਅਤੇ ਆਪਣਾ ਰਾਜ ਕਰਦੇ ਰਹਿਣਾ ਹਕੂਮਤ ਕਰਦੇ ਨੇ ਇੱਥੋਂ ਦੀ ਪ੍ਰਜਾ ਨੂੰ ਉਹ ਗੁਲਾਮ ਬਣਾ ਕੇ ਰੱਖਣ ਦੀ ਸੋਚ ਰੱਖਦੇ ਰਹਿਣਾ ਅਤੇ ਬੜੀ ਹੱਦ ਤੱਕ ਉਹਨਾਂ ਨੇ ਭਾਰਤ ਦੀ ਪ੍ਰਜਾ ਨੂੰ ਸਤਾਇਆ ਕਲਪਾਇਆ ਅਤੇ ਸੋਸ਼ਣ ਕੀਤਾ ਸਭ ਤੋਂ ਜ਼ਿਆਦਾ ਸੋਸ਼ਣ ਜਿਹੜਾ ਉਹ ਅੰਗਰੇਜ਼ ਹਕੂਮਤ ਨੇ ਕੀਤਾ ਜਿਸ ਨੇ ਭਾਰਤ ਦਾ ਕੱਚਾ ਮਾਲ ਭਾਰਤ ਦੇ ਵਿੱਚੋਂ ਲਿਜਾ ਕੇ ਇੰਗਲੈਂਡ ਦੀ ਮੰਡੀ ਦੇ ਇੰਗਲੈਂਡ ਦੀ ਫੈਕਟਰੀ ਦੇ ਵਿੱਚ ਮਾਲ ਤਿਆਰ ਕਰਕੇ ਮਹਿੰਗੇ ਦਾਮਾਂ 'ਤੇ ਭਾਰਤ ਵਿੱਚ ਵੇਚਿਆ ਅਤੇ ਭਾਰਤ ਤੋਂ ਕੱਚਾ ਮਾਲ ਬੜੇ ਸਸਤੇ ਦਾਮਾਂ ਦੇ ਵਿੱ ਤੋਂ ਲੈ ਕੇ ਅਤੇ ਮਹਿੰਗਾ ਕਰਕੇ ਬਣਾ ਕੇ ਚੀਜ਼ ਜਿਹੜੀ ਆ ਉਹ ਵੇਚੀ